ਮੋਹਾਲੀ ਜ਼ਿਲ੍ਹੇ ਵਿੱਚ ਸਥਾਨਕ ਖੇਡਾਂ ਬਹੁਤ ਤਰ੍ਹਾਂ ਦੀਆਂ ਖੇਡੀਆਂ ਜਾਂਦੀਆਂ ਹਨ ਜਿਹਨਾਂ ਵਿੱਚ ਕ੍ਰਿਕਟ ਵਾਲੀਬਾਲ ਕਬੱਡੀ ਸ਼ਾਮਲ ਹੈ ਕ੍ਰਿਕਟ ਦੇ ਲਈ ਮੋਹਾਲੀ ਨੌ ਫੇਸ ਦੇ ਵਿੱਚ ਗਰਾਊਂਡ ਸਥਿਤ ਹੈ ਜਿੱਥੇ ਆਈ ਪੀ ਐੱਲ ਦੇ ਮੈਚਿਸ ਹੁੰਦੇ ਹਨ ਦੌੜਾਂ ਵਾਲੀਬਾਲ ਕਬੱਡੀ ਲਈ ਅਲੱਗ ਜਗ੍ਹਾ 'ਤੇ ਗਰਾਊਂਡ ਹੈ ਜਿੱਥੇ ਹਰ ਸਾਲ ਪ੍ਰੋਗਰਾਮ ਕੀਤੇ ਜਾਂਦੇ ਹਨ ਖੇਡਾਂ ਖੇਡੀਆਂ ਜਾਦੀਆਂ ਹਨ ਅਤੇ ਤਾਂ ਜੋ ਖੇਡ ਪੱਧਰ ਨੂੰ ਉੱਚਾ ਚੁੱਕਿਆ ਜਾ ਸਕੇ ਮੰਨੋਰੰਜਨ ਦੇ ਲਈ ਸਿਨੇਮਾ ਘਰ ਪਾਰਕਾਂ ਮੌਜੂਦ ਹਨ ਜਿੱਥੇ ਕਿ ਲੋਕ ਕ ਸ਼ਾਮੀ ਸਵੇਰੇ ਇਕੱਠੇ ਹੁੰਦੇ ਹਨ ਅਤੇ ਆਪਸੀ ਭਾਈਚਾਰਾ ਵਧਾਉਂਦੇ ਹਨ ਸਿਨੇਮਾ ਘਰਾਂ ਵਿੱਚ ਲੋਕ ਫਿਲਮਾਂ ਦੇਖਣ ਜਾਂਦੇ ਹਨ ਅਤੇ ਖਰੀਦਦਾਰੀ ਕਰਨ ਜਾਂਦੇ ਹਨ ਉੱਥੇ ਜਾ ਕੇ ਆਪਸੀ ਭਾਈਚਾਰਾ ਵੱਧਦਾ ਹੈ ਅਤੇ ਸ਼ਾਮੀ ਗੁਰਦੁਆਰਾ ਸਾਹਿਬ ਵੀ ਬਹੁਤ ਨੇ ਜਿੱਥੇ ਲੋਕ ਸੁਬਹ ਸਵੇਰੇ ਇਕੱਠ ਸ਼ਾਮੀ ਇਕੱਠੇ ਹੁੰਦੇ ਹਨ